ਪੰਜ ਹਜ਼ਾਰ ਚਾਰ ਸੌ ਤਿੰਨ ਹਜ਼ਾਰ ਦੋ ਸੌ ਅੱਠ ਹਜ਼ਾਰ ਛੇ ਸੌ ਸੱਤ ਹਜ਼ਾਰ ਦੋ ਸੌ ਨੌ ਹਜ਼ਾਰ ਪੰਜ ਸੌ